ਹਾਂਜੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਕੋਵਿਡ ਨਾਈਨਟੀਨ ਦੇ ਟੀਕਾਕਰਨ ਟੀਕਾ ਲਗਵਾਉਣ ਲਈ ਸਾਡੇ ਪਿੰਡ ਵਿੱਚ ਇੱਕ ਡਿਸਪੈਂਸਰੀ ਹੈ ਅਸੀਂ ਸਾਰੇ ਉੱਥੋਂ ਹੀ ਡਿਸ ਡਿਸਪੈਂਸਰੀ ਦੇ ਵਿੱਚੋਂ ਟੀਕਾ ਲਗਵਾਉਂਦੇ ਹਾਂ ਅਤੇ ਇਸ ਦੇ ਨਾਲ ਅਸੀਂ ਇਸਦੇ ਕੋਵਿਡ ਨਾਈਨਟੀ ਦੇ ਟੀਕੇ ਤਿੰਨ ਤਿੰਨ ਵਾਰ ਲਗਵਾਏ ਜਾਂਦੇ ਹਨ ਇਹ ਤਿੰਨੋਂ ਹੀ ਸਾਡੇ ਬਹੁਤ ਜ਼ਰੂਰੀ ਆ ਅਤੇ ਇਹ ਸਾਨੂੰ ਟੀਕਾ ਲਗਵਾਉਣ ਅਤੇ ਲਗਵਾਉਣੇ ਚਾਹੀਦੇ ਹਨ ਕਿਉਂਕਿ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਨਾ ਲਗਵਾਉਣ ਦੇ ਕਾਰਨ ਇਸ ਇਸ ਦੇ ਨਾਲ ਸਾਨੂੰ ਕਈ ਭਿ ਭਿਆਨਕ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਜਿਸ ਤੋਂ ਬਚਾ ਦੇ ਲਈ ਅਸੀਂ ਕੋਵਿਡ ਨਾਈਨਟੀ ਦੇ ਤਿੰਨੋਂ ਟੀਕਾਕਰਨ ਸਾਨੂੰ ਲਗਵਾਉਣੇ ਬਹੁਤ ਜ਼ਰੂਰੀ ਹੈ ਅਸੀਂ ਲਗਵਾ ਕੇ ਕਈ ਰੋਗਾਂ ਤੋਂ ਬਚਾ ਸਕਦੇ ਹਨ ਧੰਨਵਾਦ ਜੀ